ਮੈਂ ਆਪਣੇ ਨਾਲ ਥੋੜ੍ਹਾ ਸਮਾਂ ਗੁਜ਼ਾਰਨਾ ਚਾਹੁੰਦਾ ਹਾਂ ਅਤੇ ਮੈਂ ਇਸ ਦੇ ਵਿੱਚ ਕਿਸੇ ਨੂੰ ਵੀ ਸ਼ਾਮਿਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰਾ ਕਿਸੇ ਨਾਲ ਵੀ ਗੱਲ ਕਰਨ ਨੂੰ ਮਨ ਨਹੀਂ ਕਰ ਰਿਹਾ ਮੈਂ ਚਾਹੁੰਦਾ ਹਾਂ ਕਿ ਥੋੜ੍ਹਾ ਸਮੇਂ ਲਈ ਮੈਂ ਕੇਵਲ ਆਪਣੇ ਆਪ ਨਾਲ ਰਹਾਂ ਇਸ ਲਈ ਮੈਂ ਇੱਕ ਫਿਲਮ ਦੇਖਣ ਦਾ ਪਲੈਨ ਕਰ ਰਿਹਾਂ ਹਾਂ ਜਿਹੜੀ ਕਿ ਇੱਕ ਇਨਸਾਨ ਬਾਰੇ ਹੈ ਲਾਲ ਸਿੰਘ ਚੱਡਾ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਅੱਗੇ ਵੱਧਦਾ ਹੈ ਮੈਂ ਆਪਣੀ ਜ਼ਿੰਦਗੀ ਨੂੰ ਲੈ ਕੇ ਥੋੜ੍ਹਾ ਜਿਹਾ ਰਾਹ ਹੀਨ ਹਾਂ ਅਤੇ ਮੈਂ ਉਸ ਫਿਲਮ ਰਾਹੀਂ ਦੇਖਣਾ ਚਾਹੁੰਦਾ ਹਾਂ ਕਿ ਮੈਨੂੰ ਉਸਦੇ ਰਾਹੀਂ ਕੁਛ ਸਿੱਖਣ ਨੂੰ ਮਿਲ ਸਕਦਾ ਹੈ ਇਸ ਰਾਹੀਂ ਮੈਂ ਕਿਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਸਾਰੇ ਕੰਮ ਕਾਰ ਛੱਡ ਕੇ ਇਕੱਲਾ ਹੀ ਉਸ ਮੂਵੀ ਨੂੰ ਫਿਲਮ ਨੂੰ ਦੇਖਾਂ ਅਤੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਸਮੇਂ ਜਾ ਕੇ ਉਹ ਫਿਲਮ ਦੇਖਾਂ ਕਿਉਂਕਿ ਮੈਂ ਹਰ ਸਫੇ ਕਿਸੇ ਨਾ ਕਿਸੇ ਨਾਲ ਘਿਰਿਆ ਰਹਿੰਦਾ ਹਾਂ ਅਤੇ ਮੈਨੂੰ ਇਸ ਬਾਰੇ ਮੇਰੀ ਮਦਦ ਕਰੋ ਕਿ ਮੈਂ ਕਿਸ ਸਮੇਂ ਜਾ ਕੇ ਉਹ ਫਿਲਮ ਦੇਖ ਸਕਦਾ ਹਾਂ